ਸਾਡੇ ਖਿਆਲ ਵਿੱਚ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਵਿੱਚ ਪੰਛੀ ਦੇਖਣ ਦੀ ਇਹ ਭੂਮਿਕਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਪੰਛੀਆਂ ਦੀ ਚਹਿਚਹਾਟ ਬਹੁਤ ਹੀ ਮਨ ਨੂੰ ਖੁਸ਼ ਕਰ ਦਿੰਦੀ ਹੈ ਇਕ ਸ਼ਾਂਤ ਵਾਤਾਵਰਨ ਦੇ ਵਿੱਚ ਇਹਨਾਂ ਦਾ ਖੁਸ਼ ਹੋਣਾ ਮਨ ਨੂੰ ਸਕੂਨ ਦਿੰਦਾ ਹੈ ਪੰਛੀਆਂ ਦੀ ਚਹਿਚਹਾਟ ਦੇ ਨਾਲ ਮਨ ਜਿਹੜਾ ਹੈ ਉਹ ਖੁਸ਼ ਹੋ ਜਾਂਦਾ ਹੈ ਸਾਨੂੰ ਇਹਨਾਂ ਦੇ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਵਿੱਚ ਪੰਛੀ ਪੰਛੀਆਂ ਨੂੰ ਦੇਖਣ ਦੀ ਬਹੁਤ ਸ ਸੋਹਣੀ ਭੂਮਿਕਾ ਨਿਭਾਉਣ ਦਾ ਮੌਕਾ ਦੇਣਾ ਚਾਹੀਦਾ ਹੈ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਜਿਹੜੀ ਹੈ ਸੋਹਣੇ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ ਇਹਨਾਂ ਦੇ ਆਸ ਪਾਸ ਪੰਛ ਥੋੜ੍ਹਾ ਰੌਲਾ ਲੱਪਾ ਦੀ ਘੱਟ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਪਾਣੀ ਇਹਨਾਂ ਨੂੰ ਇੱਕ ਖੁੱਲ੍ਹੇ ਬਰਤਨ ਦੇ ਵਿੱਚ ਪਾਣੀ ਹੋਣਾ ਚਾਹੀਦਾ ਹੈ ਇਹਨਾਂ ਦੇ ਚੋਗਾ ਹੋਣਾ ਚਾਹੀਦਾ ਹੈ ਤਾਂ ਕਿ ਪੰਕਸ਼ ਪਕਸ਼ੀ ਜਿਹੜੇ ਹੈ ਉਹ ਸੋਹਣੇ ਤਰੀਕੇ ਦੇ ਨਾਲ ਆ ਕੇ ਉਥੋਂ ਖਾ ਪੀ ਸਕਣ ਔਰ ਅਲੱਗ ਅਲੱਗ ਇਨਵਾਇਰਮੈਂਟ ਜਿਹੜਾ ਹੈ ਸਾਡਾ ਉਹ ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਹੈ ਹਰਿਆ ਭਰਿਆ ਸ ਮਤਲਬ ਹੋਣਾ ਚਾਹੀਦਾ ਹੈ ਸਾਰਾ ਕੁਝ ਤਾਂ ਕਿ ਵੱਧ ਤੋਂ ਵੱਧ ਪਕਸ਼ੀ ਉੱਥੇ ਆਉਣ ਔਰ ਸਾਨੂੰ ਇਸ ਤੋਂ ਇਲਾਵਾ ਜਿਹੜੀਆਂ ਆਪਣੇ ਅੱਜ ਕੱਲ੍ਹ ਦੀਆਂ ਚਾਈਨਾ ਡੋਰ ਹੈ ਅਲੱਗ ਅਲੱਗ ਟਾਵਰ ਲੱਗ ਗਏ ਨੇ ਗੌਰਮੈਂਟ ਨੂੰ ਉਹਨਾਂ ਦੇ ਲਈ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਿਹੜੇ ਹੈ ਉਹ ਮਤਲਬ ਘੱਟ ਹੀ ਮਤਲਬ ਪਤੰਗਾਂ ਦੀ ਜਿਹੜੀ ਡੋਰ ਹੈ ਉਹਦੇ ਵਿੱਚ ਫਸ ਕੇ ਪਕਸ਼ੀ ਕਾਫੀ ਮਰ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਰਨਾ ਚਾਹੀਦਾ ਹੈ